ਮੈਂ ਸੋਚਦੀ ਹਾਂ ਵੀ ਜਿਹੜਾ ਅੱਜ ਕੱਲ੍ਹ ਟੀ ਵੀ ਵਿੱਚ ਪ੍ਰੋਗਰਾਮ ਆਉਂਦੇ ਹੈ ਜਿਵੇਂ ਡਾਂਸ ਨੂੰ ਪ੍ਰਮੋਟ ਕਰਦੇ ਹੈ ਉਹ ਡਾਂਸ ਦੇ ਸ਼ੋਅ ਕਾਫ਼ੀ ਆਉਂਦੇ ਹੈ ਸੀਗਿੰਗ ਦੇ ਵੀ ਆਉਂਦੇ ਹੈ ਔਰ ਡਾਂਸ ਦੇ ਵੀ ਆਉਂਦੇ ਹੈ ਉਹਦੇ ਨਾਲ਼ ਸਾਡੇ ਬੱਚਿਆਂ ਨੂੰ ਬਹੁਤ ਹੀ ਇੱਕ ਸੇਧ ਮਿਲਦੀ ਹੈ ਵੀ ਅਸੀਂ ਵੀ ਅੱਗੇ ਜਾ ਕੇ ਅੱਛਾ ਡਾਂਸ ਕਰੀਏ ਔਰ ਡਾਂਸ ਉਹਨਾਂ ਨੂੰ ਕਰਨ ਦੀ ਪ੍ਰੇਰਨਾ ਮਿਲਦੀ ਹੈ ਅੱਗੇ ਇਸ ਕਰਕੇ ਬੱਚੇ ਮਾਂ ਬਾਪ ਜਿਹੜੇ ਹੈ ਆਪਣੇ ਬੱਚਿਆਂ ਨੂੰ ਉਹ ਡਾਂਸ ਸਿੱਖਣ ਲਾ ਰਹੇ ਹੈ ਔਰ ਜਿਹੜਾ ਸੋਸ਼ਲ ਮੀਡੀਆ 'ਤੇ ਵੀ ਵਾਰ ਵਾਰ ਅੱਜ ਡਾਂਸ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਇਹਦੇ ਨਾਲ਼ ਸਾਡੇ ਬੱਚਿਆਂ ਦੇ ਸ਼ੌਂਕ ਜ਼ਿਆਦਾ ਡਾਂਸ ਵੱਲ੍ਹ ਹੋ ਰਿਹਾ ਹੈ ਵੈਸੇ ਚੰਗੀ ਗੱਲ ਹੈ ਬੱਚੇ ਕਿਸੇ ਚੰਗੇ ਪਾਸੇ ਲੱਗਣਗੇ ਉਹ ਅੱਗੇ ਜਾ ਕੇ ਹੋਰ ਬਹੁਤ ਅੱਛੇ ਅੱਛੇ ਡਾਂਸਰ ਪੰਜਾਬ ਵਿੱਚੋਂ ਨਿਕਲਣਗੇ ਅੱਗੇ ਅੱਗੇ ਬਹੁਤ ਅੱਗੇ ਤੱਕ ਜਾਣਗੇ